ਮੇਰੀ ਇੱਕ ਡਰਾਇੰਗ ਜਿਹਦੇ ਵਿੱਚ ਮੈਂ ਇੱਕ ਲੜਕੀ ਦੀ ਵੀ ਡਰਾਇੰਗ ਬਣਾਈ ਸੀ ਉਹਦੇ ਵਿੱਚ ਮੈਂ ਇਹ ਦਰਸਾਇਆ ਸੀ ਕਿ ਕਿਵੇਂ ਇੱਕ ਲੜਕੀ ਆਪਣੇ ਵਿਆਹ ਤੋਂ ਬਾਅਦ ਦੁਖੀ ਹੋ ਕੇ ਘਰ ਰਹਿੰਦੀ ਹੈ ਅਤੇ ਉਸ ਡਰਾਇੰਗ ਕਰਦੇ ਸਮੇਂ ਸਭ ਤੋਂ ਪਹਿਲਾਂ ਤਾਂ ਮੈਨੂੰ ਉਹਦੀਆਂ ਸਿਰਫ ਅੱਖਾਂ ਜੋ ਕਿ ਸਾਨੂੰ ਅੱਖਾਂ ਭਰੀਆਂ ਚਿੱਤਰਕਾਰੀ ਕਰਨ ਵਿੱਚ ਬਹੁਤ ਮੁਸ਼ਕਲ ਆਈ ਜਿਹਦੇ ਵਿੱਚ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਮੈਂ ਕਿੱਦਾਂ ਕਰਾਂ ਕਿ ਮੈਂ ਆਪਣੀ ਇਹ ਅੱਖਾਂ ਨੂੰ ਕਿੱਦਾਂ ਦਰਸਾਵਾਂ ਕਿ ਉਹ ਕੁੜੀ ਇੱਡੀ ਜ਼ਿਆਦਾ ਦੁਖੀ ਹੈ ਕਿ ਉਹ ਆਪਣੇ ਕੁਛ ਕਰ ਹੀ ਨਹੀਂ ਸਕਦੀ ਕਿਉਂ ਕਿਉਂਕਿ ਸਿਰਫ ਉਹਨੂੰ ਇੱਕ ਪਿਆਰ ਨਹੀਂ ਮਿਲਿਆ ਜਾਂ ਉਹਦੀ ਪੜ੍ਹਾਈ ਨਹੀਂ ਪੂਰੀ ਹੋਈ ਇਸ ਲਈ ਮੈਂ ਇਹ ਚਿੱਤਰਕਰਨ ਕਾਰੀ ਕਰ ਰਹੀ ਸੀ ਜਿਹਦੇ ਕਰਕੇ ਉਹਨੂੰ ਪੂਰੀ ਦੁਨੀਆ ਤੋਂ ਠੁਕਰਾਇਆ ਜਾਂਦਾ ਅਤੇ ਉਸ ਚਿੱਤਰਕਾਰੀ ਕਰਦੇ ਸਮੇਂ ਮੈਨੂੰ ਸਭ ਤੋਂ ਜ਼ਿਆਦਾ ਉਹ ਸਿਰਫ ਉਸ ਦੀਆਂ ਅੱਖਾਂ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆਈ ਅਤੇ ਜਿਹਦੇ ਕਰਕੇ ਮੈਂ ਉਸਦੇ ਰੰਗ ਇੱਕਦਮ ਵਧੀਆ ਦਿੱਤੇ ਸੀ ਪਰ ਉਹਦੀਆਂ ਅੱਖਾਂ ਹੀ ਸਭ ਤੋਂ ਜ਼ਿਆਦਾ ਮੈਨੂੰ ਮੁਸ਼ਕਲਾਂ ਦੇ ਵਿੱਚ ਪਾ ਰਹੀਆਂ ਸੀ ਕਿ ਮੈਂ ਇਹਨੂੰ ਕਿੱਦਾਂ ਕ ਉਹ ਪੂਰਾ ਕਰ ਸਕਾਂ ਜੋ ਕਿ ਜੋ ਕਿ ਜਲਦ ਹੋ ਸਕੇ ਕਿਉਂਕਿ ਮੇਰਾ ਆਖਰੀ ਸ ਟਾਈਮ ਦੇਣ ਦਾ ਬਹੁਤ ਨਜ਼ਦੀਕ ਸੀ ਅਤੇ ਇਹ ਮੈਨੂੰ ਬਹੁਤ ਜ਼ਿਆਦਾ ਤਕਲੀਫ ਦੇ ਰਿਹਾ ਸੀ ਅਤੇ ਬਹੁਤ ਹੀ ਮੁਸ਼ਕਲ ਦੇ ਨਾਲ ਮੈਂ ਉਹ ਡਰਾਇੰਗ ਨੂੰ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਤਾਂ ਕਿ ਮੇਰੇ ਅੰਦਰ ਦੇ ਜਜ਼ਬਾਤ ਜੋ ਵੀ ਸੀ ਉਹ ਉਹਦੇ ਵਿੱਚ ਚਿੱਤਰਕਾਰੀ ਦੇ ਵਿੱਚ ਦਰਸਾਏ ਜਾਣ ਪੂਰੀ ਚੰਗੀ ਤਰ੍ਹਾਂ